ਪੰਦਰਾਂ ਅਗਸਤ ਉੱਨੀ ਸੌ ਸੱਤਰ ਦਸ ਜਨਵਰੀ ਉੱਨੀ ਸੌ ਸੱਤਰ ਇਕੱਤੀ ਜੁਲਾਈ ਦੋ ਹਜ਼ਾਰ ਚੌਦਾਂ ਫਰਵਰੀ ਦੋ ਹਜ਼ਾਰ ਇੱਕ ਇਕੱਤੀ ਦਸਬੰਰ ਉੱਨੀ ਸੌ ਛਿਆਨਵੇਂ